ਮੈਨੂੰ ਜੂਨ ਤੋਂ ਜਨ ਲੈ ਕੇ ਜਨਵਰੀ ਦੇ ਵਿੱਚ ਵਿੱਚ ਮੌਸਮਾਂ ਵਿੱਚ ਘੁੰਮਣਾ ਬਹੁਤ ਹੀ ਵਧੀਆ ਲੱਗਦਾ ਹੈ ਮਤਲਬ ਕਿ ਨਾ ਹੀ ਜ਼ਿਆਦਾ ਠੰਡ ਹੁੰਦੀ ਹੈ ਨਾ ਹੀ ਗਰਮੀ ਹੁੰਦੀ ਹੈ ਔਰ ਬਹੁਤ ਹੀ ਵਧੀਆ ਮੌਸਮ ਹੁੰਦਾ ਹੈ ਅਸੀਂ ਕਿਤੇ ਵੀ ਬਹੁਤ ਹੀ ਆਸਾਨੀ ਨਾਲ ਜਾ ਸਕਦੇ ਹਾਂ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕੱਪੜਾ ਪਾ ਸਕਦੇ ਹਾਂ ਔਰ ਜਿੱਦਾਂ ਕਿ ਵਿਆਹ ਸ਼ਾਦੀਆਂ ਦਾ ਸੀਜ਼ਨ ਚੱਲਦਾ ਹੈ ਤਾਂ ਉੱਥੇ ਅਗਰ ਜ਼ਿਆਦਾ ਠੰਡ ਹੋਏ ਤਾਂ ਜ਼ਿਆਦਾ ਹੈਵੀ ਕੱਪੜੇ ਪਾਉਣੇ ਪੈਂਦੇ ਆ ਅਤੇ ਜਿਸ ਕਰਕੇ ਵਧੀਆ ਵੀ ਨਹੀਂ ਲੱਗਦੇ ਔਰ ਜ਼ਿਆਦਾ ਗਰਮੀ 'ਚ ਵੀ ਬਹੁਤ ਹੀ ਬੁਰਾ ਹਾਲ ਹੁੰਦਾ ਹੈ ਇਸ ਕਰਕੇ ਜੂਨ ਤੋਂ ਲੈ ਕੇ ਜਨਵਰੀ ਦੇ ਵਿੱਚ ਵਿੱਚ ਜੋ ਮੌਸਮ ਹੁੰਦੇ ਹੈ ਇਹਨਾਂ ਮੌਸਮਾਂ 'ਚ ਮੈਨੂੰ ਘੁੰਮਣਾ ਬਹੁਤ ਹੀ ਜ਼ਿਆਦਾ ਵਧੀਆ ਲੱਗਦਾ ਹੈ ਔਰ ਅਸੀਂ ਬੇਚਿੰਤ ਹੋ ਕੇ ਕਿਤੇ ਵੀ ਘੁੰਮ ਸਕਦੇ ਹਾਂ ਠੰਡੀ ਠੰਡੀ ਹਵਾ ਜਾਂ ਫਿਰ ਕੁਝ ਵੀ ਖਾਣ ਦਾ ਵੀ ਦਿਲ ਕਰੇ ਇਹਨਾਂ ਮੌਸਮਾਂ 'ਚ ਬਹੁਤ ਹੀ ਵਧੀਆ ਲੱਗਦਾ ਹੈ ਅਤੇ ਅਸੀਂ ਇਹਨਾਂ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਮਨੋਰੰਜਨ ਕਰਦੇ ਹਾਂ ਇਹਨਾਂ ਮੌਸਮਾਂ ਵਿੱਚ ਅਸੀਂ ਕਿਤੇ ਵੀ ਘੁੰਮਣ ਜਾ ਸਕਦੇ ਹਾਂ